ਜਦ ਮੈਂ ਖਾਣਾ ਬਣਾਉਣ ਲੱਗਦੀ ਹਾਂ ਤਾਂ ਸਭ ਤੋਂ ਪਹਿਲਾਂ ਮੈਂ ਸਬਜ਼ੀ ਬਜ਼ਾਰ 'ਚੋਂ ਲਿਆ ਕੇ ਉਹਨੂੰ ਚੰਗੀ ਤਰ੍ਹਾਂ ਧੋਂਦੀ ਹਾਂ ਫਿਰ ਉਹਨੂੰ ਕੱਟਦੀ ਹਾਂ ਕੱਟਣ ਤੋਂ ਬਾਅਦ ਧੋਂਦੀ ਹਾਂ ਜਿਵੇਂ ਕਿ ਆਪਾਂ ਨੋਰਮਲ ਲਾ ਕੇ ਚੱਲਦੇ ਹਾਂ ਗੋਭੀ ਗੋਭੀ ਨੂੰ ਪਹਿਲਾਂ ਤਾਂ ਚਲੋ ਧੋਣਾ ਹੀ ਧੋਣਾ ਆ ਬਜ਼ਾਰ 'ਚੋਂ ਆਉਂਦੀ ਗੰਦੇ ਮੰਦੇ ਹੱਥ ਲੱਗਦੇ ਨੇ ਪਰ ਜਦ ਮੈਂ ਕੱਟਦੀ ਹਾਂ ਉਸ ਤੋਂ ਬਾਅਦ ਮੈਂ ਉਹਨੂੰ ਚੰਗੀ ਤਰ੍ਹਾਂ ਉਬਾਲ ਕੇ ਗਰਮ ਪਾਣੀ 'ਚ ਵੀ ਦ ਨਮਕ ਪਾ ਕੇ ਫਿਰ ਉਹਨੂੰ ਸਾਫ ਕਰਦੀ ਹਾਂ ਜੋ ਉਹਦੇ ਬੈਕਟੀਰੀਆ ਹੁੰਦੇ ਨੇ ਜਰਮ ਹੁੰਦੇ ਨੇ ਉਹਨਾਂ ਨੂੰ ਮੈਂ ਮਾਰਦੀ ਹਾਂ ਉਸ ਤੋਂ ਬਾਅਦ ਉਹਨੂੰ ਫਿਰ ਸਾਫ ਪਾਣੀ ਨਾਲ ਧੋ ਕੇ ਤਾਂ ਜਾ ਕੇ ਸਬਜ਼ੀ ਬਣਾਉਂਦੀ ਹਾਂ ਸਬਜ਼ੀ ਬਣਾਉਣ ਵੇਲੇ ਵੀ ਸਾਵਧਾਨੀਆਂ ਜਿਵੇਂ ਕਿ ਜਦ ਸਟਾਰਟਿੰਗ ਆਪਾਂ ਰੋਟੀ ਸਬਜ਼ੀ ਬਣਾਉਣ ਲੱਗਦੇ ਹਾਂ ਭਾਂਡੇ ਨੂੰ ਚੰਗੀ ਤਰ੍ਹਾਂ ਸਾਫ ਕਰੋ ਧੋਵੋ ਧੋ ਕੇ ਉਹਦੇ ਵਿੱਚ ਫਿਰ ਜੋ ਵੀ ਆਪਣਾ ਤੇਲ ਪਾਉਣਾ ਜਾਂ ਕੁਛ ਵੀ ਕਰਨਾ ਉਹ ਕਰੋ ਸਬਜ਼ੀ ਬਣਾਉਣ ਪਕਾਉਣ ਨੂੰ ਧੀਮੀ ਫਲੇਮ 'ਤੇ ਹੀ ਬਣਾਓ ਕਿਉਂਕਿ ਜੇ ਆਪਾਂ ਤੇਜ਼ ਸਬਜ਼ੀ ਬਣਾਉਂਦੇ ਹਾਂ ਜਾਂ ਕਰਦੇ ਹਾਂ ਉਹ ਪੱਕਦੀ ਪੱਕਦੀ ਹੈ ਬਸ ਉਹਦਾ ਟੇਸਟ ਨਹੀਂ ਰਹਿੰਦਾ ਜਾਂ ਆਪਾਂ ਹੌਲੀ ਦੇਣੀ ਮੋਹ ਪਿਆਰ ਪਿਆਰ ਨਾਲ ਚੀਜ਼ ਬਣਾਉਂਦੇ ਹਾਂ ਉਹਦੇ ਵਿੱਚ ਬਰਕਤ ਵੀ ਰਹਿੰਦੀ ਆ ਔਰ ਸਬਰ ਵੀ ਰਹਿੰਦਾ ਜੇ ਪਰ ਸਬਜ਼ੀ ਬਣਾਉਣ ਵੇਲੇ ਆਪਾਂ ਗੁਰਬਾਣੀ ਦਾ ਜਾਪ ਕਰਦੇ ਹਾਂ ਮਿੱਠਾ ਮਿੱਠਾ ਕੋਈ ਸ਼ਬਦ ਬੋਲ ਲਿਆ ਕੋਈ ਗੁਰਬਾਣੀ ਦਾ ਪਾਠ ਪੜ੍ਹ ਲਿਆ ਉਹਦੇ ਨਾਲ ਕੀ ਹੁੰਦਾ ਖਾਣ ਵਾਲੇ ਨੂੰ ਸਬਰ ਰਹਿੰਦਾ ਔਰ ਉਹਦੇ ਅੰਦਰ ਸਬਰ ਸੰਤੋਖ ਵੀ ਪੈ ਜਾਂਦਾ ਵੀ ਸ਼ਾਂਤੀ ਨਾਲ ਉਹਦੇ ਅੰਦਰ ਗੁਰਬਾਣੀ ਦਾ ਅਸਰ ਜਾਂਦਾ ਏ ਆ ਜਦ ਵੀ ਕਿਤੇ ਰਸੋਈ ਵਿੱਚ ਜਾਂ ਕੁਛ ਵੀ ਆਪਾਂ ਖਾਣਾ ਬਣਾਉਂਦੇ ਜਾਂ ਬ ਕਰਦੇ ਹਾਂ ਉਹਦੇ ਉਸ ਟਾਈਮ 'ਤੇ ਔਰਤ ਨੂੰ ਜ਼ਰੂਰ ਚਾਹੀਦਾ ਹੈ ਕਿ ਉਹ ਆਪਣਾ ਗੁਰਬਾਣੀ ਦਾ ਪਾਠ ਪੜ੍ਹੇ ਘਰ ਵਿੱਚ ਸੁੱਖ ਸ਼ਾਂਤੀ ਰਵੇ ਔਰ ਸਭ ਕੁਛ ਸਹੀ ਸਲਾਮਤ ਚੱਲੇ